ਸਥਾਨਕ ਇੰਨਡੋਰ ਗੇਮਾਂ ਦੇ ਵਿੱਚੋਂ ਮੈਨੂੰ ਸਤ ਸ਼ਤਰੰਜ ਬਹੁਤ ਪਸੰਦ ਹੈ ਸ਼ਤਰੰਜ ਦੀ ਖੇਡ ਇੱਕ ਤਾਂ ਸਿਰਫ ਦੋ ਲੋਕਾਂ ਦੇ ਵਿੱਚ ਹੀ ਖੇਡਿਆ ਜਾਂਦਾ ਹੈ ਅਤੇ ਇੱਕ ਦਿਮਾਗੀ ਖੇਡ ਹੈ ਇਹਦੇ ਵਿੱਚ ਜਿਵੇਂ ਘੋੜਾ ਢਾਈ ਕਦਮ ਚੱਲਦਾ ਹਾਥੀ ਸਿੱਧਾ ਚੱਲਦਾ ਹੈ ਅਤੇ ਸਿਪਾਹੀ ਜਦੋਂ ਆਪਣੇ ਅਖੀਰਲੇ ਮੁਕਾਮ 'ਤੇ ਪਹੁੰਚ ਜਾਂਦੇ ਹਨ ਤਾਂ ਉਹਨਾਂ ਦੇ ਬਦਲੇ ਦੇ ਵਿੱਚ ਉੱਥੇ ਖੜ੍ਹਾ ਜੋ ਵੀ ਰਾਣੀ ਹੋਵੇਗੀ ਜਾਂ ਪਿਆਦਾ ਹੋਵੇਗਾ ਉਹ ਆਪਾਂ ਨੂੰ ਵਾਪਸ ਮਿਲ ਜਾਂਦਾ ਔਰ ਇਸ ਥੋੜ੍ਹਾ ਸੋਚ ਸੋਚ ਕੇ ਖੇਡਣਾ ਪੈਂਦਾ ਹੈ ਖੇਡ ਔਰ ਜਦੋਂ ਜਿਹੜਾ ਵੀ ਬੰਦਾ ਇਸਨੂੰ ਜਿੱਤ ਲੈਂਦਾ ਹੈ ਅਤੇ ਉਸਨੂੰ ਇੱਕ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਮੈਂ ਉਸਨੂੰ ਦੂਸਰੇ ਨੂੰ ਹਰਾ ਦਿੱਤਾ